ਹੁਸ਼ਿਆਰਪੁਰ ਵਿੱਚ ਕਾਫੀ ਕੁਦਰਤੀ ਸਰੋਤ ਹੈਗੇ ਨੇ ਜਿਹੜੇ ਵਪਾਰਕ ਕੰਮਾਂ ਲਈ ਵਰਤੇ ਜਾ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਇੱਥੋਂ ਦੀ ਜ਼ਮੀਨ ਬਹੁਤ ਉਪਜਾਊ ਹੈ ਇਸ ਲਈ ਖੇਤੀਬਾੜੀ ਇੱਥੇ ਦਾ ਮੁੱਖ ਕਿੱਤਾ ਹੈ ਆਪਾਂ ਕਣਕ ਚੌਲ ਗੰਨਾ ਅਤੇ ਸਬਜ਼ੀਆਂ ਬਹੁਤ ਉਗਾਉਂਦੇ ਹਾਂ ਇਹ ਸਾਰਾ ਕੁਝ ਕਿਸਾਨਾਂ ਤੋਂ ਲੈ ਕੇ ਫੂਡ ਪ੍ਰੋਸੈਸਿੰਗ ਦੇ ਵੰਡਣ ਵਾਲੇ ਕਾਰੋਬਾਰਾਂ ਤੱਕ ਸਭ ਲਈ ਫਾਇਦੇਮੰਦ ਹੈ ਫਿਰ ਇੱਥੇ ਖਣਿਜ ਪਦਾਰਥ ਵੀ ਹੈਗੇ ਹਨ ਜਿਵੇਂ ਕਿ ਰੇਤਲਾ ਪੱਥਰ ਅਤੇ ਬਜਰੀ ਜਿਹੜੇ ਉਸਾਰੀ ਵਿੱਚ ਵਰਤੇ ਜਾਂਦੇ ਹਨ ਮੈਂ ਕੋਈ ਮਾਹਰ ਤਾਂ ਨਹੀਂ ਪਰ ਮੈਨੂੰ ਸੁਣਿਆ ਹੈ ਕਿ ਇੱਥੇ ਹੋਰ ਖਣਿਜਾਂ ਦੀ ਵੀ ਸੰਭਾਵਨਾ ਹੈ ਸ਼ਿਵਾਲਿਕ ਪਹਾੜੀਆਂ ਦੇ ਨੇੜੇ ਹੋਣ ਕਰਕੇ ਇੱਥੇ ਜੰਗਲਾਤ ਵੀ ਹੈਗੇ ਨੇ ਪਹਿਲਾਂ ਇੱਥੇ ਲੱਕੜ ਦਾ ਕੰਮ ਜ਼ਿਆਦਾ ਹੁੰਦਾ ਸੀ ਪਰ ਅੱਜ ਕੱਲ੍ਹ ਸਥਾਈ ਜੰਗਲਾਤ ਅਤੇ ਜੰਗਲੀ ਸਰੋਤਾਂ ਨੂੰ ਜ਼ਿੰਮੇਵਾਰੀ ਨਾਲ ਵਰਤਣ 'ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਜਿਵੇਂ ਕਿ ਦਵਾਈਆਂ ਵਾਲੇ ਬੂਟੇ ਜਾਂ ਇਕੋ ਟੂਰਿਜਮ ਲਈ ਅਤੇ ਬੇਸ਼ੱਕ ਪਾਣੀ ਤਾਂ ਬਹੁਤ ਜ਼ਰੂਰੀ ਹੈ ਇੱਥੇ ਦਰਿਆ ਅਤੇ ਧਰਤੀ ਹੇਠਲਾ ਪਾਣੀ ਹੈ ਜਿਹੜਾ ਖੇਤੀਬਾੜੀ ਦੇ ਇੰਡਸਟਰੀ ਦੋਵਾਂ ਲਈ ਬਹੁਤ ਮਹੱਤਵਪੂਰਨ ਹੈ ਪਰ ਪਾਣੀ ਨੂੰ ਸਹੀ ਤਰੀਕੇ ਨਾਲ ਵਰਤਣ ਵਰਤਣਾ ਇੱਕ ਵੱਡੀ ਚੁਣੌਤੀ ਹੈ ਖਾਸ ਕਰਕੇ ਜਦੋਂ ਮੌਸਮ ਵਿੱਚ ਤਬਦੀਲੀਆਂ ਆ ਰਹੀਆਂ ਨੇ ਮੈਂ ਇੱਥੇ ਖੇਤੀਬਾੜੀ ਦੇ ਸਰੋਤ ਕੁਝ ਖਣਿਜ ਜੰਗਲਾਤ ਦੀ ਸੰਭਾਵਨਾ ਅਤੇ ਪਾਣੀ ਇਹ ਸਭ ਚੀਜ਼ਾਂ ਨੇ ਜਿਹੜੀਆਂ ਵੱਖ ਵੱਖ ਵਪਾਰਕ ਕੰਮਾਂ ਲਈ ਵਰਤੀਆਂ ਜਾ ਸਕਦੀਆਂ ਨੇ ਪਰ ਇਹਨਾਂ ਨੂੰ ਸਹੀ ਢੰਗ ਨਾਲ ਵਰਤਣਾ ਬਹੁਤ ਜ਼ਰੂਰੀ ਹੈ ਜੋ ਇਹ ਅੱਗੇ ਵੀ ਰਹਿ ਸਕਣ